ਮੇਰਾ ਨਾਮ ਰੰਜਨ ਮੈਂ ਪਿੰਡ ਟੋਂਸੇ ਦਾ ਵਾਸੀ ਹਾਂ ਮੈਂ ਆਪਣੀ ਪੜ੍ਹਾਈ ਪਿੰਡ ਟੋਂਸੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਾਈ ਕੀਤੀ ਇੱਥੋਂ ਪਾਸ ਹੋਣ ਤੋਂ ਬਾਅਦ ਮੈਨੂੰ ਹਾਈ ਸਕੂਲ ਵਿੱਚ ਐਡਮਿਸ਼ਨ ਲੈਣੀ ਸੀਗੀ ਮੈਂ ਕਾਫੀ ਸਕੂਲ ਦੀ ਭਾਲ ਕੀਤੀ ਫਿਰ ਮੈਨੂੰ ਰੋ ਸਾਡੇ ਪਿੰਡ ਦੇ ਨਾਲ ਸ਼ਹਿਰ ਲੱਗਦਾ ਰੋਪੜ ਮੈਂ ਇੱਥੋਂ ਟੀਊਸ਼ਨ ਲਈ ਮੈਂ ਉੱਥੇ ਡੀ ਏ ਵੀ ਪਬਲਿਕ ਸਕੂਲ 'ਚ ਪੜ੍ਹਿਆ ਛੇਵੀਂ ਤੋਂ ਲੈ ਕੇ ਬਾਰਵੀਂ ਤੱਕ ਮੈਂ ਆਪਣੀ ਬਾਰਵੀਂ ਦੀ ਤੱਕ ਦੀ ਪੜ੍ਹਾਈ ਡੀ ਏ ਵੀ ਸਕੂਲ ਵਿੱਚ ਕ ਪੂਰੀ ਕਰੀ ਬਾਰਵੀਂ ਕਰਨ ਤੋਂ ਬਾਅਦ ਮੈਨੂੰ ਇੱਕ ਕੋਲਜ ਦੀ ਭਾਲ ਸੀਗੀ ਫਿਰ ਜਾ ਕੇ ਮੈਂ ਇੱਕ ਕੋਲਜ ਦੀ ਤਲਾਸ਼ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਂ ਸਹੋੜਾ ਐਡਮਿਸ਼ਨ ਲਈ ਰਿਆਤ ਬਾਹਰਾ ਯੂਨੀਵਸਵਰਸਿਟੀ ਵਿੱਚ ਉੱਥੇ ਜਾ ਕੇ ਹੁਣ ਮੈਂ ਬੀ ਸੀ ਏ ਕਰਦਾ ਹਾਂ ਇੱਥੇ ਕਾਫੀ ਸਹੂਲਤਾਂ ਹਨ ਮੇਰੇ ਬੇ ਸੀ ਏ ਕੰਪਲੀਟ ਹੋਣ ਤੋਂ ਬਾਅਦ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੀ ਐੱਮ ਸੀ ਏ ਵੀ ਇੱਥੋਂ ਹੀ ਕਰਾਂ ਇੱਥੇ ਪਲੇਸਮੈਂਟ ਦੀ ਬਹੁਤ ਖਿਆਲ ਰੱਖਿਆ ਜਾਂਦਾ ਹੈ